ਸਾਡੇ ਇਲਾਕੇ ਵਿੱਚ ਖੇ ਕਲਾ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈ ਜਿਵੇਂ ਸਾਡੇ ਘਰਾਂ ਵਿੱਚ ਜਿਵੇਂ ਸਲਾਈ ਕਢਾਈ ਹੁੰਦੀ ਹੈ ਉਹ ਸਾਡੇ ਪਹਿਲਾਂ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੀ ਉਹ ਸਾਨੂੰ ਅੱਗੇ ਤੋਂ ਹੁਣ ਸਿੱਖਣ ਨੂੰ ਮਿਲ ਰਿਹਾ ਹੈ ਅੱਗੇ ਤੋਂ ਅਸੀਂ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਜਿਵੇਂ ਘਰਾਂ 'ਚ ਖਰੌਸ਼ੀਆ ਕੱਢਿਆ ਜਾਂਦਾ ਸਾਡੇ ਪੁਰਾਣੇ ਬਜ਼ੁਰਗ ਹੈ ਜਿਹੜੇ ਉਹ ਪਹਿਲਾਂ ਪੱਖੀਆਂ ਬਣਾਉਂਦੇ ਹੁੰਦੇ ਸੀ ਉਹ ਤਾਂ ਮੰਮੀ ਨੇ ਸਾਨੂੰ ਵੀ ਸਿਖਾਇਆ ਹੋਇਆ ਵੀ ਅਸੀਂ ਅੱਗੇ ਤੋਂ ਆਪਣੇ ਬੱਚਿਆਂ ਨੂੰ ਵੀ ਸਿਖਾ ਸਕਦੇ ਹਾਂ ਉਹ ਸਿਰਫ਼ ਡੈਕੋਰੇਸ਼ਨ ਪੀਸ ਹੀ ਸਹੀ ਪਰ ਫਿਰ ਵੀ ਚੱਲ ਆਪਣੀ ਕਲਾ ਦਾ ਇੱਕ ਉਹ ਵੀ ਇੱਕ ਕਲਾ ਆਪਣੀ ਅੱਗੇ ਤੋਂ ਪਹੁੰਚਾਉਣੀ ਚਾਹੀਦੀ ਹੈ ਆਪਣੀ ਵਿਰਾਸਤ ਅੱਗੇ ਦੇਣੀ ਚਾਹੀਦੀ ਹੈ ਜਿਵੇਂ ਹੁਣ ਅਸੀਂ ਪਹਿਲਾਂ ਜਿਹੜੇ ਸ਼ੁਰੂ ਤੋਂ ਹੀ ਜਿਵੇਂ ਆਪਣੇ ਰੀਤੀ ਰਿਵਾਜਾਂ ਨਾਲ਼ ਮੱਥੇ ਵਗੈਰਾ ਟੇਕਦੇ ਹੈ ਜਿਹੜੇ ਉਹ ਅੱਗੇ ਤੋਂ ਅਸੀਂ ਆਪਣੇ ਬੱਚਿਆਂ ਨੂੰ ਵੀ ਪਾਸ ਔਨ ਕਰ ਰਹੇ ਬਸ ਹੁਣ ਬੋਲ ਹੋ ਗਿਆ